ਭਾਰਤ ਵਿੱਚ ਲੋਕ ਵੱਖਰੇ ਵੱਖਰੇ ਧਾਰਮਿਕ ਸਥਾਨਾਂ 'ਤੇ ਜਾਂਦੇ ਹਨ ਇੱਥੇ ਬਹੁਤ ਸਾਰੇ ਪ੍ਰਸਿੱਧ ਧਾਰਮਿਕ ਸਥਾਨ ਸਥਾਪਿਤ ਹਨ ਜਿਵੇਂ ਕਿ ਹਿੰਦੂਆਂ ਦੇ ਜਗਨਨਾਥ ਅਤੇ ਸੋਮਨਾਥ ਮੰਦਰ ਬਹੁਤ ਹੀ ਪ੍ਰਸਿੱਧ ਹਨ ਅਤੇ ਸਿੱਖਾਂ ਦਾ ਸ਼੍ਰੀ ਗੁਰੂ ਹਰਿਮੰਦਰ ਸਾਹਿਬ ਜੋ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਾਪਿਤ ਹੈ ਉਹ ਬਹੁਤ ਪ੍ਰਸਿੱਧ ਹੈ ਇੱਥੇ ਲੋਕ ਦੂਰੋਂ ਦੂਰੋਂ ਚੱਲ ਕੇ ਦਰਸ਼ਨ ਕਰਨ ਆਉਂਦੇ ਹਨ ਸੋਮਨਾਥ ਮੰਦਰ ਜੋ ਕਿ ਸ਼ਿਵਜੀ ਜੀ ਦਾ ਪ੍ਰਸਿੱਧ ਮੰਦਿਰ ਹੈ ਇੱਥੇ ਹਰ ਸਾਲ ਹੀ ਸ਼ਿਵਰਾਤਰੀ ਜੀ ਦਾ ਬਹੁਤ ਹੀ ਪ੍ਰੋਗਰਾਮ ਲੱਗਦਾ ਹੈ ਦੂਰੋਂ ਦੂਰੋਂ ਲੋਕ ਚੱਲ ਕੇ ਸ਼ਿਵਰਾਤਰੀ ਦੇਖਣ ਆਉਂਦੇ ਹਨ ਜਗਨਨਾਥ ਜੋ ਕਿ ਸ਼੍ਰੀ ਕ੍ਰਿਸ਼ਨ ਜੀ ਦਾ ਮੰਦਰ ਹੈ ਇੱਥੇ ਹਰ ਸਾਲ ਹੀ ਸ਼੍ਰੀ ਕ੍ਰਿਸ਼ਨ ਜੀ ਦੀ ਅਸ਼ਟਮੀ ਮਨਾਈ ਜਾਂਦੀ ਹੈ ਜਨਮ ਅਸ਼ਟਮੀ ਹਰ ਸਾਲ ਹੀ ਮਨਾਈ ਜਾਂਦੀ ਹੈ ਦੂਰੋਂ ਦੂਰੋਂ ਲੋਕ ਚੱਲ ਕੇ ਇੱਥੇ ਅਸ਼ਟਮੀ ਜੀ ਦਾ ਪ੍ਰੋਗਰਾਮ ਦੇਖਣ ਆਉਂਦੇ ਹਨ ਸ਼੍ਰੀ ਗੁਰੂ ਹਰਿਮੰਦਰ ਸਾਹਿਬ ਜੀ ਜੋ ਕਿ ਸਿੱਖਾਂ ਦਾ ਪ੍ਰਸਿੱਧ ਗੁਰਦੁਆਰਾ ਹੈ ਇੱਥੇ ਹਰ ਸਾਲ ਹੀ ਦੀਵਾਲੀ ਦਾ ਬਹੁਤ ਹੀ ਵੱਡਾ ਪ੍ਰੋਗਰਾਮ ਲੱਗਦਾ ਹੈ ਹਰ ਮਹੀਨੇ ਸੰਗਰਾਂਦ ਅਤੇ ਮੱਸਿਆ ਦਾ ਦਿਹਾੜਾ ਮਨਾਇਆ ਜਾਂਦਾ ਹੈ ਇੱਥੇ ਹਰ ਸਾਲ ਸ਼੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ